ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦਾਸਪੁਰ ਤੋਂ ਬੋਲਦੀ ਪਈ ਹਾਂ ਮੈਂ ਅੱਜ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਗੱਲ ਕਰਨ ਲੱਗੀ ਹਾਂ ਕਿ ਜੋ ਪੰਜਾਬੀ ਭਾਸ਼ਾ ਹੈ ਉਹ ਸਮੇਂ ਦੇ ਨਾਲ ਨਾਲ ਬਦਲਦੀ ਜਾ ਰਹੀ ਆ ਲੋਕ ਜ਼ਿਆਦਾ ਪੰਜਾਬੀ ਨੂੰ ਪੰਜਾਬੀ ਦੀ ਜਗ੍ਹਾ ਇੰਗਲਿਸ਼ ਨੂੰ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਆ ਪਰ ਜੋ ਕਿ ਪੰਜਾਬੀ ਭਾਸ਼ਾ ਹੈ ਉਹ ਸਭ ਤੋਂ ਵਧੀਆ ਹੈ ਇਹਦੇ ਨਾਲ ਸਾਡੇ ਸੱਭਿਆਚਾਰ 'ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ ਸੱਭਿਆਚਾਰ ਸਾਡਾ ਪੰਜਾਬੀ ਵਿਰਸਾ ਜੋ ਕਿ ਬਹੁਤ ਵਧੀਆ ਹੈ ਪਰ ਇੰਗਲਿਸ਼ ਆਉਣ ਨਾਲ ਇਹ ਜੋ ਪੰਜਾਬੀ ਭਾਸ਼ਾ ਹੈ ਉਹ ਪਿੱਛੇ ਜਾਈ ਜਾ ਰਹੀ ਹੈ ਅਤੇ ਇੰਗਲਿਸ਼ ਜਿਹੜੀ ਆ ਉਹ ਸਾਰੇ ਸਕੂਲਾਂ ਵਿੱਚ ਵੀ ਸਭ ਤੋਂ ਅੱਗੇ ਹੋ ਰਹੀ ਹੈ ਇਸ ਲਈ ਆਪਣੇ ਪੰਜਾਬੀ ਸੱਭਿਆਚਾਰ ਨੂੰ ਮੁੜ ਲਿਆਉਣ ਲਈ ਸਾਨੂੰ ਪੰਜਾਬੀ ਭਾਸ਼ਾ ਬਾਰੇ ਬੱਚਿਆਂ ਨੂੰ ਗਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਆਉਣ ਵਾਲੇ ਟਾਈਮ ਵਿੱਚ ਪੰਜਾਬੀ ਭਾਸ਼ਾ ਨੂੰ ਜਾਰੀ ਰੱਖ ਸਕਣ ਪੰਜਾਬੀ ਭਾਸ਼ਾ ਚੰਗੇ ਤਰੀਕੇ ਨਾਲ ਬੋਲ ਸਕਣ ਅਤੇ ਸੁਣ ਸਕਣ ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦੀ ਵਰਤੋਂ ਹਰ ਸਮੇਂ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਭਾਸ਼ਾ ਸ ਸਾਡੇ ਲਈ ਬਹੁਤ ਵਧੀਆ ਹੈ ਸੱਭਿਆਚਾਰਨ ਸੱਭਿਆਚਾਰ ਨੂੰ ਵਿਰਾਸਤ ਵਿੱਚ ਰੱਖਣ ਲਈ ਪੰਜਾਬੀ ਭਾਸ਼ਾ ਦੇ ਬਹੁਤ ਪ੍ਰਮੁੱਖ ਪੰਜਾਬੀ ਭਾਸ਼ਾ ਨੂੰ ਉੜੇ ਤੋਂ ਲੈ ਕੇ ਸੱਸੇ ਪੈਰੀਂ ਬਿੰਦੀ ਤੱਕ ਸ ਸਾਨੂੰ ਪਹਿਲੇ ਸਕੂਲ ਵਿੱਚ ਇਹ ਹੀ ਜ਼ਿਆਦਾ ਪੰਜਾਬੀ ਭਾਸ਼ਾ ਹੀ ਪੜ੍ਹਾਈ ਜਾਂਦੀ ਸੀ ਲੇਕਿਨ ਹੁਣ ਜੋ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਪੰਜਾਬੀ ਭਾਸ਼ਾ ਬਾਰੇ ਨਹੀਂ ਦੱਸਿਆ ਜਾਂਦਾ ਅਤੇ ਅੰਗਰੇਜ਼ੀ ਭਾਸ਼ਾ ਬਾਰੇ ਦੱਸਿਆ ਜਾਂਦਾ ਹੈ ਇਸ ਲਈ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਪੰਜਾਬੀ ਭਾਸ਼ਾ ਬੋਲਣੀ ਚਾਹੀਦੀ ਹੈ